ਦੋ ਜੂਨ ਦੋ ਹਜ਼ਾਰ ਤੇਈ ਉੱਨੀ ਅਕਤੂਬਰ ਉੱਨੀ ਸੌ ਸਤਾਨਵੇਂ ਵੀਹ ਅਕਤੂਬਰ ਦੋ ਹਜ਼ਾਰ ਇੱਕ ਅੱਠ ਮਾਰਚ ਉੱਨੀ ਸੌ ਪਚਾਨਵੇਂ ਇੱਕ ਜਨਵਰੀ ਉੱਨੀ ਸੌ ਛਿਆਨਵੇਂ